ਸਾਡਾ ਪੰਜਾਬ ਗੱਲਾਂ ਵਿੱਚ ਬਹੁਤ ਹੀ ਮਸ਼ਹੂਰ ਹੈ ਸਾਡੇ ਪੰਜਾਬ ਵਿੱਚ ਹਰ ਇੱਕ ਚੀਜ਼ ਬੜੇ ਹੀ ਜਸ਼ਨ ਨਾਲ ਮਨਾਈ ਜਾਂਦੀ ਹੈ ਪੰਜਾਬ ਵਿੱਚ ਰਸਮਾਂ ਜਸ਼ਨਾਂ ਘਰੇਲੂ ਚੀਜ਼ਾਂ ਬਹੁਤ ਹੀ ਧੂਮ ਧਾਮ ਨਾਲ ਮਨਾਈ ਜਾਂਦੀ ਹਨ ਪੰਜਾਬ ਵਿੱਚ ਜੱਦ ਵੀ ਕੋਈ ਵਿਆਹ ਹੁੰਦਾ ਹੈ ਤਾਂ ਉੱਥੇ ਹਰ ਇੱਕ ਰਸਮ ਚੰਗੀ ਤਰ੍ਹਾਂ ਮਨਾਈ ਜਾਂਦੀ ਹੈ ਲੋਕ ਵਿਆਹ ਤੋਂ ਕੁਛ ਦਿਨ ਪਹਿਲਾਂ ਹੀ ਆ ਜਾਂਦੇ ਹਨ ਅਤੇ ਖੂਬ ਧੂਮ ਧਾਮ ਨਾਲ ਨੱਚਦੇ ਟੱਪਦੇ ਅਤੇ ਵਿਆਹ ਦੀ ਵਿਆਹ ਦਾ ਜਸ਼ਨ ਮਨਾਉਂਦੇ ਹਨ ਅਤੇ ਪੰਜਾਬ ਵਿੱਚ ਵਿਆਹ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਜੇ ਪੰਜਾਬ ਵਿੱਚ ਕੋਈ ਵੀ ਤਿਉਹਾਰ ਆਉਂਦਾ ਹੈ ਤਾਂ ਲੋਕ ਉਸ ਨੂੰ ਵੀ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਮਨਾਉਂਦੇ ਹਨ ਪੰਜਾਬ ਵਿੱਚ ਹਰ ਇੱਕ ਚੀਜ਼ ਬਹੁਤ ਹੀ ਧੂਮ ਧਾਮ ਨਾਲ ਮਨਾਈ ਜਾਂਦੀ ਹੈ ਪੰਜਾਬ ਵਿੱਚ ਤਿਉਹਾਰ ਮਨਾਉਣ ਨਾਲ ਬਹੁਤ ਹੀ ਅਨੰਦ ਆਉਂਦਾ ਹੈ ਜੇਕਰ ਪੰਜਾਬ ਵਿੱਚ ਕੋਈ ਵੀ ਬਾਹਰ ਦਾ ਤਿਉਹਾਰ ਮਨਾਉਣ ਆਉਂਦਾ ਹੈ ਤਾਂ ਉਹ ਬਹੁਤ ਹੀ ਖੁਸ਼ ਹੋ ਕੇ ਜਾਂਦਾ ਹੈ ਪੰਜਾਬ ਵਿੱਚ ਕੋਈ ਵੀ ਵਿਆਹ ਹੋਵੇ ਜਾਂ ਕੋਈ ਵੀ ਜਸ਼ਨ ਹੋਵੇ ਕੋਈ ਵੀ ਘਰੇਲੂ ਕੋਈ ਵੀ ਘਰੇਲੂ ਰੋਜ਼ਾਨਾ ਕੋਈ ਵੀ ਕੋਈ ਵੀ ਜਸ਼ਨ ਹੋਵੇ ਤਾਂ ਪੰਜਾਬ ਵਿੱਚ ਉਹ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਇਸ ਕਰਕੇ ਪੰਜਾਬ ਨੂੰ ਨੱਚਣ ਟੱਪਣ ਅਤੇ ਜਸ਼ਨ ਮਨਾਉਣ ਵਿੱਚ ਵੀ ਸਭ ਤੋਂ ਪਹਿਲੇ ਨੰਬਰ 'ਤੇ ਕਿਹਾ ਗਿਆ ਹੈ ਇਸ ਕਰਕੇ ਪੰਜਾਬ ਦੇ ਲੋਕ ਹਰ ਇੱਕ ਚੀਜ਼ ਨੂੰ ਬਹੁਤ ਹੀ ਧੂਮ ਧਾਮ ਨਾਲ ਮਨਾਉਂਦੇ ਹਨ ਧੰਨਵਾਦ